ਪੰਜਾਬ ਵਿੱਚ ਪਰੰਪਰਾਗਤ ਮੌਕਿਆਂ 'ਤੇ ਗਿੱਧਾ ਤੀਆਂ ਭੰਗੜਾ ਪਾਇਆ ਜਾਂਦਾ ਹੈ ਲੋਹੜੀ ਪੰਜਾਬ ਵਿੱਚ ਮੁੰਡੇ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਇਹਨਾਂ ਪਰੰਪਰਾਗਤ ਮੌਕਿਆਂ 'ਤੇ ਕੁੜੀਆਂ ਸਲਵਾਰ ਕਮੀਜ਼ ਫੁਲਕਾਰੀ ਦੁਪੱਟਾ ਲੈਂਦੀਆਂ ਹਨ ਅਤੇ ਗਹਿਣਿਆਂ ਨਾਲ ਤਿਆਰ ਹੁੰਦੀਆਂ ਹਨ ਇਸ ਤਰ੍ਹਾਂ ਮੁੰਡੇ ਚਾਦਰਾ ਖੰਡਾ ਲੈਂਦੇ ਹਨ ਅਤੇ ਹੱਥ ਵਿੱਚ ਸੋਟਾ ਫੜਦੇ ਹਨ ਅਤੇ ਉਹ ਭੰਗੜੇ ਵਾਲੇ ਕੁੜੀਆਂ ਅਤੇ ਮੁੰਡੇ ਰਲ ਕੇ ਭੰਗੜਾ ਪਾਉਂਦੇ ਹਨ ਅਲੱਗ ਅਲੱਗ ਗੀਤਾਂ 'ਤੇ ਭੰਗੜੇ ਪਾਏ ਜਾਂਦੇ ਹਨ ਬੋਲੀਆਂ ਅਤੇ ਪਾਏ ਜਾਂਦੇ ਹਨ ਇਸ ਤਰ੍ਹਾਂ ਰਿਵਾਇਤੀ ਕੱਪੜਿਆਂ ਦੇ ਨਾਲ ਅਤੇ ਗਹਿਣਿਆਂ ਦੇ ਨਾਲ ਆਪਣੇ ਪੰਜਾਬੀ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹ ਬਹੁਤ ਹੀ ਪਰੰਪਰਾਗਤ ਹੁੰਦੇ ਹਨ ਇਹਨਾਂ ਤਿਉਹਾਰਾਂ ਵਿੱਚ ਬਹੁਤ ਹੀ ਜ਼ਿਆਦਾ ਮਨੋਰੰਜਨ ਹੁੰਦਾ ਹੈ